ਅਸੀਂ ਸਾਰੇ ਜਾਣਦੇ ਹੀ ਹਾਂ ਕਿ ਪੌਦੇ ਮੌਸਮ ਦੇ ਉੱਤੇ ਬਹੁਤ ਨਿਰਭਰ ਕਰਦੇ ਹਨ ਕਿਉਂਕਿ ਇਹਨਾਂ ਨੂੰ ਉਗਾਉਣ ਤੋਂ ਬਾਅਦ ਸਾਨੂੰ ਮੀਂਹ ਹਨੇਰੀਆਂ ਧੁੱਪ ਆਦਿ ਤੋਂ ਬਚਾਉਣ ਦੀ ਬਹੁਤ ਲੋੜ ਹੁੰਦੀ ਹੈ ਅੱਜ ਕੱਲ੍ਹ ਜਿਹੜੇ ਕਿਸਾਨ ਵੱਡੇ ਨੇ ਉਹਨਾਂ ਵੱਲੋਂ ਪਲਾਸਟਿਕ ਨਾਲ਼ ਬਣੇ ਸ਼ੈੱਡਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਜੋ ਕਿ ਇੱਕ ਜੋ ਕਿ ਇੱਕ ਬਹੁਤ ਹੀ ਵਧੀਆ ਤਰੀਕਾ ਹੈ ਇਸ ਤੋਂ ਬਿਨਾ ਹੋਰ ਵੀ ਬਹੁਤ ਢੰਗ ਤਰੀਕੇ ਨੇ ਜਿਨ੍ਹਾਂ ਨਾਲ਼ ਅਸੀਂ ਇਹਨਾਂ ਨੂੰ ਵੱਖ ਵੱਖ ਮੌਸਮਾਂ ਤੋਂ ਬਚਾ ਸਕਦੇ ਹਾਂ ਜਿਸ ਤਰ੍ਹਾਂ ਅਸ ਅਸੀਂ ਮੌਸਮ ਸੰਬੰਧੀ ਇੰਟਰਨੈੱਟ ਤੋਂ ਪਹਿਲਾਂ ਹੀ ਜਾਣਕਾਰੀ ਲੈ ਸਕਦੇ ਹਾਂ ਅਤੇ ਪੌਦਿਆਂ ਦੇ ਬੀਜਣ ਦਾ ਜੋ ਸਮਾਂ ਹੈ ਅਸੀਂ ਉਸ ਨੂੰ ਬਦਲ ਸਕਦੇ ਹਾਂ ਜੇਕਰ ਲੱਗੇ ਕਿ ਮੀਂਹ ਜ਼ਿਆਦਾ ਪੈ ਗਿਆ ਹੈ ਤਾਂ ਉਸਦੇ ਪਾਣੀ ਨੂੰ ਕੱਢਣ ਲਈ ਪਹਿਲਾਂ ਹੀ ਸਾਨੂੰ ਪ੍ਰਬੰਧ ਕਰਨਾ ਚਾਹੀਦਾ ਹੈ ਛੋਟੇ ਫੁੱਲਾਂ ਵਾਲੇ ਪੌਦਿਆਂ ਦੇ ਗਮਲਿਆਂ ਨੂੰ ਅਸੀਂ ਮੀਂਹ ਪੈਣ ਤੋਂ ਪਹਿਲਾਂ ਹੀ ਸੁਰੱਖਿਅਤ ਜਗ੍ਹਾ 'ਤੇ ਰੱਖ ਸਕਦੇ ਹਾਂ ਅਤੇ ਸਾਨੂੰ ਬਾਰਿਸ਼ ਦੇ ਦਿਨਾਂ ਵਿੱਚ ਪਾਣੀ ਘੱਟ ਦੇਣਾ ਚਾਹੀਦਾ ਹੈ ਇਸ ਤੋਂ ਬਿਨਾ ਜੋ ਖਾਦ ਪਦਾਰਥ ਨੇ ਉਹ ਪਾਣੀ ਨੂੰ ਸੋਖਣ ਵਿੱਚ ਬਹੁਤ ਮਦਦ ਕਰਦੇ ਨੇ ਇਸ ਲਈ ਸਾਨੂੰ ਖਾਦ ਪਦਾਰਥਾਂ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ ਰੇਨ ਕਵਰ ਨਾਲ਼ ਵੀ ਅਸੀਂ ਪੌਦਿਆਂ ਨੂੰ ਢੱਕ ਸਕਦੇ ਹਾਂ ਜੋ ਇਹਨਾਂ ਨੂੰ ਧੁੱਪ ਹਨੇਰੀ ਅਤੇ ਮੀਂਹ ਤੋਂ ਬਚਾਉਂਦੇ ਨੇ ਹਨੇਰੀ ਤੋਂ ਬਾਅਦ ਪੌਦਿਆਂ ਨੂੰ ਅਸੀਂ ਮਜ਼ਬੂਤ ਲੱਕੜੀ ਦਾ ਸਹਾਰਾ ਦੇ ਕੇ ਵੀ ਬਚਾ ਸਕਦੇ ਹਾਂ ਅੱਜ ਕੱਲ੍ਹ ਵੇ ਵੇਲ ਵਾਲੇ ਪੌਦਿਆਂ ਨੂੰ ਜਾਲੀ ਦੇ ਸਹਾਰੇ ਨਾਲ਼ ਵੀ ਬਚਾਇਆ ਜਾ ਸਕਦਾ ਹੈ ਇਸ ਤੋਂ ਬਿਨਾ ਬਾਰਸ਼ ਦੇ ਦਿਨਾਂ ਵਿੱਚ ਪੌਦਿਆਂ ਨੂੰ ਕੀੜੇ ਲੱਗ ਜਾਂਦੇ ਨੇ ਜੋ ਕਿ ਬਹੁਤ ਨੁਕਸਾਨ ਕਰਦੇ ਨੇ ਇਸ ਲਈ ਉਹਨਾਂ ਦੇ ਉੱਪਰ ਆਰਗੈਨਿਕ ਪਦਾਰਥਾਂ ਦੀ ਵਰਤੋਂ ਕਰਕੇ ਵੀ ਇਹਨਾਂ ਨੂੰ ਬਚਾਇਆ ਜਾ ਸਕਦਾ ਹੈ ਧੰਨਵਾਦ